ਹੈਲੋ ਹਾਂਜੀ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਠੀਕ ਹੈ ਠੀਕ ਹੈ ਵੀਰੇ ਪੀਜੀ ਤਾਂ ਦੇਖੋ ਭਾਅ ਜੀ ਤੁਹਾਨੂੰ ਇੱਥੇ ਪੀਜੀ ਪਟਿਆਲੇ ਤੁਹਾਨੂੰ ਪੈ ਜੂਗਾ ਵਧੀਆ ਪੰਤਾਲੀ ਸੌ ਤੋਂ ਪੰਜ ਹਜ਼ਾਰ ਦਾ ਹਾਂਜੀ ਹਾਂਜੀ ਇਹ ਯੂਨੀਵਰਿਸਟੀ ਦੇ ਜਮ੍ਹਾਂ ਸਾਮਣੇ ਹੀ ਮਿਲ ਜੂਗਾ ਤੁਹਾਨੂੰ ਅਤੇ ਪੀਜੀ ਵਧੀਆ ਹੋਵੇਗਾ ਪੂਰਾ ਸਾਫ ਸਫਾਈ ਪੂਰੀ ਵਧੀਆ ਰੱਖੀ ਹੋਈ ਹੋਵੇਗੀ ਅਤੇ ਪੀਜੀ ਦੇ ਵਿੱਚ ਗੱਲਬਾਤ ਇੱਦਾਂ ਹੋਣੀ ਆ ਕਿ ਤੁਸੀਂ ਸਿਰਫ ਉਹ ਕਰ ਸਕਦੇ ਹੋ ਮੁੰਡੇ ਮੁੰਡੇ ਹੀ ਆ ਸਕਦੇ ਹੋ ਬਸ ਕੁੜੀਆਂ ਅਲਾਊਡ ਨਹੀਂ ਹੈਗੀਆਂ ਇਹ ਰੂਲ ਏ ਹੁੰਦੇ ਜੀ ਪੀਜੀ ਵਾਲਿਆਂ ਦੇ ਹਾਂਜੀ ਜੇ ਤੁਸੀਂ ਕਹੋ ਤੁਹਾਨੂੰ ਪੀ ਉੱਥੇ ਕੋਠੀ ਮਿਲ ਜੂਗੀ ਫੇਸ ਟੂ ਹਾਂਜੀ ਹਾਂਜੀ ਕੋ ਕੋਠੀ ਦਾ ਇੱਦਾਂ ਤੁਹਾਨੂੰ ਹਜੇ ਪੂਰੀ ਦੀ ਪੂਰੀ ਕੋਠੀ ਲਓਂਗੇ ਤੁਹਾਨੂੰ ਦਸ ਹਜਾਰ ਦੀ ਕੋਠੀ ਪੈ ਜੂਗੀ ਪੂਰੀ ਦੀ ਪੂਰੀ ਓਹ

ਅੱਛਾ ਫਿਰ ਤਾਂ ਤੁਸੀਂ ਓਹੀ ਪੀਜੀ ਦੇਖ ਲਓ ਨਹੀਂ ਕੋਠੀ ਦੇ ਉੱਪਰ ਵੀ ਕਮਰਾ ਮਿਲ ਜੂਗਾ ਤੁਹਾਨੂੰ ਹਾਂ ਉਸ ਉੱਥੇ ਕੋਈ ਦਿੱਕਤ ਨਹੀਂ ਭਾਅ ਜੀ ਉੱਥੇ ਕੋਈ ਦਿੱਕਤ ਨਹੀਂ ਆਉਂਦੀ ਭਾਵੇਂ ਜੋ ਮਰਜ਼ੀ ਲਿਆਓ ਤੁਸੀਂ ਉਹ ਪਊ ਆਪਾਂ ਨੂੰ ਪਚਵੰਜਾ ਕੁ ਸੌ ਦਾ ਪੈ ਜੂਗਾ ਇਕੱਲਾ ਕਮਰਾ ਹਾਂਜੀ ਹਾਂਜੀ ਹਾਂਜੀ ਇਕੱਲਾ ਇਕੱਲਾ ਕਮਰਾ ਆਪਾਂ ਨੂੰ ਇਸ ਰੇਟ ਦਾ ਮਿਲ ਜੂਗਾ ਖਰਚਾ ਹਾਂਜੀ ਹਾਂਜੀ ਇਹ ਸਾਰਾ ਕੁਝ ਆਪਣਾ ਅੱਡ ਹੋਵੇਗਾ ਹਾਂਜੀ ਹਾਂਜੀ ਅਤੇ ਉਹਦੇ ਵਿੱਚ ਏ ਸੀ ਊਸੀ ਹੋਰ ਕੁਛ ਨਹੀਂ ਲੱਗਿਆ ਹੋਣਾ ਹੈਗਾ ਜਿਹੜਾ ਪੀਜੀ ਹੈ ਤੁਹਾਨੂੰ ਏ ਸੀ ਊਸੀ ਸਭ ਕੁਝ ਵਿੱਚ ਲੱਗਿਆ ਲਗਾਇਆ ਮਿਲ ਜੂਗਾ

ਹਾਂਜੀ ਹਾਂਜੀ ਹਾਂਜੀ ਬਹੁਤ ਕੁਛ ਆਪਣਾ ਦੇਖ ਲਓ ਬਾਕੀ ਬਿਜਲੀ ਦਾ ਬਿਲ ਅੱਡ ਹੋਵੇਗਾ ਬਸ ਤੁਹਾਡਾ ਹਾਂਜੀ ਹਾਂਜੀ ਬਿਲਕੁਲ ਬਾਹਲਾ ਨਹੀਂ ਆਉਂਦਾ ਜੀ ਜੋ ਤੁਹਾਨੂੰ ਦੱਸਿਆ ਮਸਾਂ ਦੋ ਢਾਈ ਸੌ ਰੁਪਇਆ ਆਵੇਗਾ ਓਹੀ ਹੈ ਤਾਹੀਂ ਕਹਿੰਦਾ ਦੋ ਢਾਈ ਸੌ ਰੁਪਈਆ ਆਉਣਾ ਬਾਹਲਾ ਨਹੀਂ ਆਉਂਦਾ ਹੈਗਾ ਤੁਹਾਨੂੰ ਐਂਏਂ ਓ ਤੁਹਾਨੂੰ ਦੇਣਾ ਪੈਣਾ ਹੀ ਉਹ ਕਿਉਂਕਿ ਤੁਸੀਂ ਯੂਜ਼ ਕਰ ਰਹੇ ਹੋ ਹਾਂਜੀ ਹਾਂਜੀ ਹਾਂਜੀ ਉਹਦਾ ਰੈਂਟ ਤਾਂ ਭਰਨਾ ਹੀ ਪੈਣਾ ਤੁਹਾਨੂੰ ਹਮ ਹਮ ਨਾ ਐਗਰੀ ਉਗਰੀਮੈਂਟ ਕੁਛ ਨਹੀਂ ਹੋਣੀ ਨਹੀਂ ਨਹੀਂ ਹਾਂਜੀ ਹਾਂਜੀ ਬਸ ਇਹੀ ਹੈ ਬਾਕੀ ਤੁਸੀਂ ਦੇਖ ਲਓ ਜੀ ਤੁਸੀਂ ਪੀਜੀ ਲੈਣਾ ਪੀਜੀ ਕਰ ਲਓ ਰੂਟ ਹੈਗਾ ਸਿੰਪਲ ਭਾਅ ਜੀ ਤੁਸੀਂ ਪਟਿਆਲਾ ਗੇਟ ਤੋਂ ਬੱਸ ਚੜ੍ਹਿਓ ਪਟਿਆਲਾ ਗੇਟ ਤੋਂ ਬੱਸ ਚੜ੍ਹਿਓ ਤੁਸੀਂ ਪੰਜਾਬੀ ਯੂਨੀਵਰਸਿਟੀ ਆਉਣਾ ਹਾਂ ਬੱਸ ਸਿੱਧਾ ਇੱਥੇ ਯੂਨੀ ਹੋਰ ਨਵੇਂ ਬੱਸ ਸਟੈਂਡ ਪਹੁੰਚੋ ਨਵੇਂ ਬੱਸ ਸਟੈਂਡ ਤੋਂ ਤੁਸੀਂ ਔਟੋ ਫੜ ਸਕਦੇ ਹੋ ਔਟੋ ਵਾਲੇ ਨੇ ਵੀਹ ਰੁਪਏ ਲੈਣੇ ਹੈ ਨਹੀਂ ਤੁਸੀਂ ਸਿੰਪਲ ਉਹ ਕਰ ਸਕਦੇ ਹੋ ਬੱਸ ਬਹਿ ਜਿਓ ਇੱਥੋਂ ਸਿੱਧੀ ਚੰਡੀਗੜ੍ਹ ਦੀ ਬੱਸ ਬੈਠੋਗੇ ਜਦੋਂ ਉਹ ਤੁਹਾਨੂੰ ਯੂਨੀਵਰਸਿਟੀ ਦੇ ਗੇਟ ਦੇ ਹੋ ਕੇ ਜਾਂਦੀ ਹੈ ਬੱਸ ਬਹਿ ਜੋ ਬੱਸ ਤੁਹਾਨੂੰ ਛੇਤੀ ਲਾਹ ਦਉਗੀ ਨਾਲੇ ਵਧੀਆ ਗੱਲ ਹੋ ਗਈ ਹਾਂਜੀ ਹਾਂਜੀ ਹਾਂਜੀ ਅਤੇ ਬਾਕੀ ਹਾਂਜੀ ਹਾਂਜੀ ਚਲੋ ਠੀਕ ਹੈ ਓਕੇ ਜੀ ਓਕੇ ਜੀ ਓਕੇ